ਹਾਂਜੀ ਨਮਸਤੇ ਹਾਂਜੀ ਹਾਂਜੀ ਇਸ ਵਿੱਚ ਨਾ ਸਾਰੀਆਂ ਕਲਾਸਾਂ ਦਾ ਹੀ ਹੈ ਵੈਸੇ ਤਾਂ ਅਤੇ ਬਾਕੀ ਮਤਲਬ ਜਿਹੜੇ ਅਲੱਗ ਅਲੱਗ ਕਲਾਸਾਂ ਦੇ ਹਿਸਾਬ 'ਤੇ ਅਲੱਗ ਅਲੱਗ ਟੋਪਿਕ ਦਿੱਤੇ ਹੋਏ ਆ ਬੱਚਿਆਂ ਨੂੰ ਅਤੇ ਜਿਵੇਂ ਕਿ ਛੋਟੇ ਬੱਚੇ ਆ ਐਲ ਕੇ ਜੀ ਵਾਲੇ ਨਰਸਰੀ ਯੂ ਕੇ ਜੀ ਵਾਲੇ ਨਰਸਰੀ ਵਾਲੇ ਉਹ ਅਲੱਗ ਅਲੱਗ ਡਰੈਸ ਪਾ ਕੇ ਆਉਣਗੇ ਜਿਵੇਂ ਫੈਂਸੀ ਫੈਂਸੀ ਡਰੈਸ ਜਿਹੜੀ ਹੈ ਨਾ ਹੁੰਦੀ ਹੈ ਇੰਡੀਪੈਂਡਸ ਡੇ 'ਤੇ ਅਲੱਗ ਅਲੱਗ ਕਲਰ ਦੀਆਂ ਕੋਈ ਵਾਈਟ ਹੋ ਗਈ ਗ੍ਰੀਨ ਹੋ ਗਈ ਤਿੰਨੋ ਕਲਰ ਹੋਣੇ ਚਾਹੀਦੇ ਆ ਹੈ ਨਾ ਕੇਸਰੀ ਰੰਗ ਹੋ ਗਿਆ ਅਤੇ ਬਾਕੀ ਜਿਹੜੇ ਹੈਗੇ ਆ ਮਤਲਬ ਫਸਟ ਵਾਲੇ ਬੱਚੇ ਉਹਨਾਂ ਦਾ ਉਹਨਾਂ ਨੇ ਮਤਲਬ ਕੁਛ ਵੀ ਬਣਾਉਣਾ ਹੋਵੇਗਾ ਇੰਡੀਪੈਂਡਸ ਡੇ 'ਤੇ ਕੋਈ ਵੀ ਪਿਕਚਰ ਬਣਾ ਕੇ ਲਿਆਉਣੀਆਂ ਨੇ ਉਵੇਂ ਦੀਆਂ ਕੋਈ ਫਲੈਗ ਵਗੈਰਾ ਹੋ ਗਿਆ ਹੈ ਨਾ ਅਤੇ ਇੱਦਾਂ ਦਾ ਹੋਵੇਗਾ ਬਾਕੀ ਅਲੱਗ ਅਲੱਗ ਕਲਾਸਾਂ ਦੇ ਹਿਸਾਬ 'ਤੇ ਹੈ ਹਾਂਜੀ ਉਹ ਨਾ ਛੋਟੇ ਬੱਚਿਆਂ ਦਾ ਤਾਂ ਸਕੂਲ ਵਿੱਚ ਹੀ ਹੁੰਦਾ ਹੈ ਅਤੇ ਛੋਟੇ ਬੱਚਿਆਂ ਦਾ ਜਿਵੇਂ ਪ੍ਰੇਅਰ ਦੇ ਟਾਈਮ 'ਤੇ ਛੋਟੇ ਬੱਚਿਆਂ ਨੂੰ ਕਰਵਾ ਕੇ ਪ੍ਰੇਅਰ ਦੇ ਟਾਈਮ ਤਾਂ ਫਿਕ ਪਿਕਸ ਵਗੈਰਾ ਉਹਨਾਂ ਦੀਆਂ ਹੋ ਜਾਂਦੀਆਂ ਨੇ ਅਤੇ ਜਿਹੜੇ ਮਤਲਬ ਫਿਫਥ ਤੱਕ ਤਾਂ ਇੱਥੇ ਹੀ ਹੁੰਦੇ ਆ ਬੱਚੇ ਜਿਹੜੇ ਅਗਾਂਹ ਮਤਲਬ ਵੱਡੀਆਂ ਕਲਾਸਾਂ ਹੈ ਸਿਕਸਥ ਟੂ ਟਵੈਂਲਥ ਤੱਕ ਉਹ ਬੱਚੇ ਮਤਲਬ ਅਗਾਂਹ ਦਾਣਾ ਮੰਡੀ ਜਾਂਦੇ ਆ ਹਾਂਜੀ ਅਤੇ ਬਾਕੀ ਥੋੜ੍ਹਾ ਜਿਹਾ ਬੱਚਿਆਂ ਨੂੰ ਤਿਆਰੀ ਕਰਵਾਉਣੀ ਹੁੰਦੀ ਹੈ ਬੱਚੇ ਕੋਈ ਵੀ ਜਿਵੇਂ ਫੋਰਥ ਫਿਫਥ ਦੇ ਬੱਚੇ ਆ ਉਹ ਕੁਛ ਵੀ ਤਿਆਰ ਕਰ ਸਕਦੇ ਆ ਜਿਵੇਂ ਕੋਈ ਆਪਣਾ ਕੁਛ ਵੀ ਬੋਲਣਾ ਚਾਹੁੰਦੇ ਆ ਇੰਡੀਪੈਂਡਸ ਡੇ 'ਤੇ ਤਾਂ ਉਹ ਬੋਲ ਸਕਦੇ ਹੁੰਦੇ ਆ ਹਾਂਜੀ ਹਾਂਜੀ ਲਿਸਟ ਤਾਂ ਬਣਾਉਣੀ ਪਵੇਗੀ ਆਪਾਂ ਨਾ ਲਿਸਟ ਬਣਾਉਣੀ ਆ ਮਤਲਬ ਕਲਾਸ ਲਿਖ ਕੇ ਫਿਰ ਬੱਚੇ ਦਾ ਨੇਮ ਨੋਟ ਕਰਨਾ ਵੀ ਕਿਹੜਾ ਬੱਚਾ ਇਹਦੇ ਵਿੱਚ ਕਰ ਰਿਹਾ ਪਾਰਟੀਸਪੇਟ ਆਪਾਂ ਉਹਦਾ ਨਾਮ ਲਿਖਣਾ ਹੁੰਦਾ ਸੀ ਠੀਕ ਹੈ ਅਤੇ ਬਾਕੀ ਉਹ ਸਿਰਫ਼ ਦਾਣਾ ਮੰਡੀ 'ਚ ਹੀ ਆਉਂਦੇ ਆ ਕਾਫ਼ੀ ਸਕੂਲਾਂ ਦੇ ਬੱਚੇ ਹੁੰਦੇ ਆ ਨਾ ਅਲੱਗ ਅਲੱਗ ਸਕੂਲਾਂ ਦੇ ਉੱਥੇ ਭਾਗ ਲੈਂਦੇ ਆ ਬੱਚੇ ਤਾਂ ਉਹ ਦਾਣਾ ਮੰਡੀ ਤੇ ਅਲੱਗ ਅਲੱਗ ਸਕੂਲਾਂ ਦੇ ਬੱਚੇ ਹੁੰਦੇ ਆ ਆਪਣੇ ਸਕੂਲ ਵਿੱਚ ਸਿਰਫ਼ ਆਪਣੇ ਸਕੂਲ ਦੇ ਹੀ ਬੱਚੇ ਹੁੰਦੇ ਆ ਕਿਉਂਕਿ ਬੱਚਿਆਂ ਨੂੰ ਤਾਂ ਕਿ ਇਸ ਬਾਰੇ ਜਾਣਕਾਰੀ ਮਿਲ ਸਕੇਗੀ ਇੰਡੀਪੈਂਡਸ ਡੇ ਕੀ ਹੈ ਬਾਅਦ ਵਿੱਚ ਫਿਰ ਉਹਨਾਂ ਦੀਆਂ ਫੋਟੋਆਂ ਵਗੈਰਾ ਕਰਵਾਈਆਂ ਜਾਂਦੀਆਂ ਨੇ ਅਲੱਗ ਅਲੱਗ ਬੱਚਿਆਂ ਦੀਆਂ ਸਾਰਿਆਂ ਦੀਆਂ ਜਿਹੜੇ ਤਿਆਰ ਹੋ ਕੇ ਆਉਂਦੇ ਆ ਹਾਂਜੀ ਹਾਂਜੀ ਫਿਰ ਜਿਹੜੀ ਡਿਵੀਜ਼ਨ ਆਉਂਦੀ ਹੈ ਜੇ ਮੰਨ ਲਓ ਕੋਈ ਬੱਚਾ ਫਸਟ ਆਇਆ ਜਿਹੜਾ ਜ਼ਿਆਦਾ ਵਧੀਆ ਲੱਗਦਾ ਕੁਛ ਵੀ ਬੱਚੇ ਦਾ ਤਾਂ ਉਹਨਾਂ ਨੂੰ ਫਿਰ ਫਸਟ ਸੈਕਿੰਡ ਥਰਡ ਪੁਜੀਸ਼ਨਾਂ ਕੱਢ ਕੇ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹੈ ਹਾਂਜੀ ਠੀਕ ਆ ਓਕੇ